ਰੂਪਨਗਰ ਜ਼ਿਲ੍ਹੇ ਵਿੱਚ ਮੌਸਮ ਠੀਕ ਹੀ ਰਹਿੰਦਾ ਹੈ ਜਿਵੇਂ ਕਿ ਗਰਮੀ ਸਰਦੀ ਬਰਸਾਤ ਗਰਮੀ ਗਰਮੀ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਪੈ ਪੈਂਦੀ ਹੈ ਅਤੇ ਗਰਮੀ ਜੂ ਜੂ ਮ ਗਰਮੀ ਜੂਨ ਜੁਲਾਈ ਜੂ ਮਈ ਜੂਨ ਵਿੱਚ ਜ਼ਿਆਦਾ ਹੀ ਪੈਂਦੀ ਹੈ ਅਤੇ ਇਸ ਵਿੱਚ ਸਾਨੂੰ ਪਤਲੇ ਪਤਲੇ ਕੱਪੜੇ ਪੈ ਪਾਉਣੇ ਪੈਂਦੇ ਹਨ ਅਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ ਔਰ ਗਰਮੀ ਦੇ ਮੌਸਮ ਵਿੱਚ ਬਹੁਤ ਸਾਰੀਆਂ ਦਿੱਕਤਾਂ ਵੀ ਆ ਜਾਂਦੀਆ ਹਨ ਸਰਦੀ ਸਰਦੀ ਦੇ ਮੌਸਮ ਵਿੱਚ ਬਹੁਤ ਹੀ ਸਰਦੀ ਹੋ ਜਾਂਦੀ ਹੈ ਦਿਸੰਬਰ ਜਨਵਰੀ ਵਿੱਚ ਇਸ ਵਿੱਚ ਅਸੀਂ ਬਹੁਤ ਹੀ ਸਾਰੀਆਂ ਚੀਜ਼ਾਂ ਦਾ ਬਹੁਤ ਹੀ ਸਾਰੀਆਂ ਚੀਜ਼ਾਂ ਦਾ ਚੀਟਰ ਕਰਨਾ ਪੜਦਾ ਹੈ ਜਿੱਦਾਂ ਵੀ ਗਰਮ ਕੱਪੜੇ ਪਹਿਨਣੇ ਹੈ ਅਤੇ ਔਰ ਵੀ ਬਹੁਤ ਸਾਰੀਆਂ ਚੀਜ਼ਾਂ ਲੈਣੀਆਂ ਪੈਂਦੀਆਂ ਹੈ ਬਰਸਾਤ ਬਰਸਾਤ ਦੇ ਮੌਸਮ ਵਿੱਚ ਅਸੀਂ ਬਹੁ ਬਾਹਰ ਵੀ ਜਾਈਏ ਤਾਂ ਬਹੁਤ ਸਾਰੇ ਸਾਨੂੰ ਰੇਨ ਕੋਟ ਵਗੈਰਾ ਪਾ ਕੇ ਹੀ ਜਾਣਾ ਪੈਂਦਾ ਹੈ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ ਹਨ ਬਰਸਾਤ ਦੇ ਮੌਸਮ ਵਿੱਚ